ਸਤਿ ਸ਼੍ਰੀ ਅਕਾਲ ਸਰ ਜੀ ਤੁਹਾਡਾ ਆਨਸਰ ਉੱਤਰ ਪ੍ਰਸ਼ਨ ਹੈ ਜੋ ਕਿ ਟੈਕਨੋਲੋਜੀ ਦਾ ਇੰਟਰਨੈਟ ਦੇ ਵਧਣ ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਕਿਵੇਂ ਬਦਲ ਗਈ ਹੈ ਉਹ ਇਸ ਦਾ ਕਾਰਨ ਹੈ ਕਿ ਟੈਕਨੋਲਜੀ ਅਤੇ ਇੰਟਰਨੈਟ ਦੇ ਵਧਣ ਨਾਲ ਜੋ ਕਿ ਆਪਣੀ ਹਿੰਦੀ ਮਾਤਰ ਭਾਸ਼ਾ ਹਰੇਕ ਨੂੰ ਅਸਾਨੀ ਦੇ ਨਾਲ ਸਮਝ ਆ ਜਾਂਦੀ ਹੈ ਕੁਛ ਵੀ ਲਾ ਲਓ ਜਿਵੇਂ ਆਪਾਂ ਬਾਹਰ ਜਾਂਦੇ ਹਾਂ ਹੋਰ ਜਾਂਦੇ ਹਿੰਦੀ ਭਾਸ਼ਾ ਸਭ ਤੋਂ ਵੱਧ ਵਰਤੀ ਜਾਂਦੀ ਆਪਣੇ ਦੇਸ਼ ਦੇ ਵਿੱਚ ਜਿਸ ਕਾਰਨ ਟੈਕਨੋਲੋਜੀ ਅਤੇ ਇੰਟਰਨੈਟ ਦੇ ਵਧਣ ਨਾਲ ਪ ਪੰਜਾਬੀ ਪੰਜਾਬੀ ਭਾਸ਼ਾ ਲੁਪਤ ਤੋਂ ਹੋ ਰਹੀ ਹੈ ਉਹ ਅਤੇ ਇੰਗਲਿਸ਼ ਅਤੇ ਇੰਗਲਿਸ਼ ਵੀ ਬਹੁਤ ਅੱਗੇ ਆ ਰਹੀ ਹੈ ਜੋ ਇੰਟਰਨੈਟ ਦੇ ਵ ਵਿਦੇਸ਼ੀ ਚੀਜ਼ਾਂ ਦੇਖਣ ਲਈ ਜਾਂ ਕੁਛ ਵੀ ਲਾ ਲਓ ਟੈਕਨੋਲਜੀ ਆ ਰਹੀ ਹੈ ਨਵੀਂ ਤੋਂ ਨਵੀਂ ਟੈਕਨੋਲੋਜੀ ਆ ਰਹੀ ਹੈ ਜਿਹਦੇ ਵਿੱਚ ਇੰਗਲਿਸ਼ ਇੰਗਲਿਸ਼ ਵਰਤੀ ਜਾਂਦੀ ਹੈ ਅਤੇ ਇਹ ਭਾਸ਼ਾ ਲੁਪਤ ਹੋਣ ਦਾ ਕਾਰਨ ਵੀ ਇਹੀ ਹੈ ਟੈਕਨੋਲਜੀ ਦੇ ਨਾਲ ਨਾਲ ਕਿਉਂਕਿ ਹਰੇਕ ਦੇ ਵਪਾਰ ਬਾਹਰ ਅੰਦਰ ਬਹੁਤ ਨੇ ਜਿਹਦੇ ਕਾਰਨ ਕਿ ਕਈ ਬੰਦਿਆਂ ਨੂੰ ਬਾਹਰ ਦਿਆਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਇਸ ਕਰਕੇ ਹਿੰਦੀ ਜਾਂ ਇੰਗਲਿਸ਼ ਬੋਲੀ ਜਾਂਦੀ ਹੈ ਅਤੇ ਸ ਉਹ ਹੁੰਦਾ ਇਸ ਲਈ ਟੈਕਨੋਲੋਜੀ ਅਤੇ ਇੰਟਰਨੈਟ ਦੇ ਵਧਣ ਨਾਲ ਪੰਜਾਬੀ ਭਾਸ਼ਾ ਦੀ ਵੀ ਵਰ ਵਰਤੋਂ ਬਦਲ ਗਈ ਹੈ